ਮੋਬਾਇਲ ਐਪਸ ਜਿਹਨਾਂ ਵਿੱਚ ਗੁਗਲ ਪਲੇ ਸਟੋਰ ਫੇਸਬੁੱਕ ਅਤੇ ਵਟਸਐਪ ਲੋਕਾਂ ਦੀ ਰੋਜ਼ਾਨਾ ਜ਼ਿੰਦਗੀ ਨੂੰ ਕਾਫੀ ਸੁਖਾਲਾ ਕਰ ਰਹੇ ਆ ਇਹਨਾਂ ਦੀ ਮਦਦ ਨਾਲ ਆਦਮੀ ਆਪਣੇ ਜਾਣ ਪਹਿਚਾਣ ਵਾਲਿਆਂ ਨੂੰ ਮੈਸੇਜ ਈਮੇਲ ਅਤੇ ਹਰ ਤਰ੍ਹਾਂ ਦੀ ਜਾਣਕਾਰੀ ਆਪਣੇ ਬਾਰੇ ਔਰ ਆਪਣੇ ਆਸ ਪਾਸ ਦੇ ਬਾਰੇ ਦਿੰਦਾ ਔਰ ਲੈਂਦਾ ਹੈ ਜਿਸ ਦੇ ਨਾਲ ਕਾਫੀ ਗਿਆਨ ਮਿਲਦਾ ਹੈ ਇਸ ਦੇ ਨਾਲ ਵਟਸਐਪ ਦੇ ਥਰੂ ਦੂਰ ਦੁਰਾਡੇ ਦੇਸ਼ਾਂ ਵਿੱਚ ਵੀ ਆਸਾਨੀ ਨਾਲ ਘਰ ਬੈਠਿਆਂ ਗੱਲ ਹੋ ਜਾਂਦੀ ਹੈ ਇਸ ਦੇ ਨਾਲ ਟਾਈਮ ਦੀ ਵੀ ਕਾਫੀ ਬੱਚਤ ਮਿਲਦੀ ਹੈ ਅਤੇ ਫੇਸ ਟੂ ਫੇਸ ਗੱਲਬਾਤ ਰਾਹੀਂ ਆਪਣੇ ਜਾਣ ਪਹਿਚਾਣ ਵਾਲਿਆਂ ਨੂੰ ਦੇਖ ਔਰ ਸੁਣ ਸਕਦੇ ਹੈ ਜਿਸ ਦਾ ਅੱਜ ਦੀ ਜ਼ਿੰਦਗੀ ਵਿੱਚ ਕਾਫੀ ਜਿਆ ਵੱਡਾ ਰੂਲ ਹੈ ਜਿਸ ਦੇ ਨਾਲ ਟਾਈਮ ਦੀ ਬੱਚਤ ਅਤੇ ਆਪਸੀ ਪਿਆਰ ਔਰ ਜਾਣਕਾਰੀਆਂ ਵਿੱਚ ਵਾਧਾ ਔਰ ਜ਼ਿੰਦਗੀ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਹਰ ਤਰ੍ਹਾਂ ਦੀ ਸਹਾਇਤਾ ਪ੍ਰਾਪਤ ਹੋ ਜਾਂਦੀ ਹੈ